ਹੈਲੋ ਭਾਅ ਜੀ ਹਾਂਜੀ ਮੇਰਾ ਨਾ ਇੱਕ ਉਰਵਸ਼ੀ ਦੇ ਨਾਮ ਦਾ ਔਡਰ ਹੈਗਾ ਸੀ ਅਤੇ ਹਾਂਜੀ ਤੁਸੀਂ ਕਿੱਥੇ ਹੈਗੇ ਹੋ ਮੇਰਾ ਐਕਚੁਲੀ ਔਡਰ 'ਚ ਇੱਕ ਨਿਊਡਲ ਦਾ ਅਤੇ ਇੱਕ ਪਾਓ ਭਾਜੀ ਹੈਗੀ ਹੈ ਅਤੇ ਮੈਂ ਬੜੇ ਟਾਈਮ ਦਾ ਔਡਰ ਦਿੱਤਾ ਹੋਇਆ ਅੱਧੇ ਘੰਟੇ ਦਾ ਦਿਖਾ ਰਹੇ ਸੀ ਹੁਣ ਘੰਟਾ ਹੋ ਗਿਆ ਹਜੇ ਤੱਕ ਆਇਆ ਨਹੀਂ ਹੈਗਾ ਅਤੇ ਮੇਰੇ ਘਰ ਗੈਸਟ ਵੀ ਵੇਟ ਕਰ ਰਹੇ ਮੈਨੂੰ ਦੱਸ ਦਿਓ ਤੁਸੀਂ ਕਿੰਨਾ ਸਮਾਂ ਲੱਗੇਗਾ ਤੁਹਾਨੂੰ ਅਤੇ ਹਾਂਜੀ ਅਤੇ ਤੁਸੀਂ ਇਸ ਟਾਈਮ ਕਿਸ ਈ ਬਲੋਕ 'ਚ ਹੈਗੇ ਹੋ ਤੁਹਾਨੂੰ ਇੱਥੇ ਆਉਣ 'ਚ ਕਿੰਨਾ ਕੁ ਟਾਈਮ ਲੱਗ ਜਾਏਗਾ ਅੱਧਾ ਘੰਟਾ ਨਹੀਂ ਸਰ ਜੀ ਜਲਦੀ ਆ ਜਾਓ ਬਿਕੋਜ ਔਲਰੇਡੀ ਬਹੁਤ ਲੇਟ ਹੋ ਚੁੱਕਾ ਅਤੇ ਉਹ ਗੈਸਟ ਵੀ ਸਾਡੇ ਵੇਟ ਕਰ ਰਹੇ ਹੈ ਖਾਣਾ ਵੀ ਠੰਡਾ ਹੋ ਜਾਏਗਾ ਤੇ ਬਹੁਤ ਮੁਸ਼ਕਿਲ ਹੋ ਜਾਣੀ ਹੈ ਤੁਸੀਂ ਪਲੀਜ਼ ਜਲਦੀ ਤੋਂ ਜਲਦੀ ਇੱਥੇ ਪਾਰਵਤੀ ਦੀ ਬੈਕ ਸਾਈਡ 'ਤੇ ਰਣਜੀਤ ਅਵੇਨਿਊ 'ਤੇ ਪਹੁੰਚ ਜਾਓ ਤਾਂ ਕਿ ਆਪਾਂ ਜਲਦੀ ਬਹੁਤ ਸਮਾਂ ਲਗਾ ਤਾ ਤੁਸੀਂ ਹਾਂਜੀ ਠੀਕ ਹੈ ਜੀ ਤੁਸੀਂ ਮੈਨੂੰ ਪਲੀਜ਼ ਦਸ ਪੰਦਰਾਂ ਮਿੰਨਟ 'ਚ ਪਲੀਜ਼ ਜਲਦੀ ਪਹੁੰਚ ਜਾਓ ਮੈਂ ਇਸ ਤੋਂ ਜ਼ਿਆਦਾ ਨਹੀਂ ਵੇਟ ਕੀ ਔਲਰੇਡੀ ਤੁਸੀਂ ਬਹੁਤ ਲੇਟ ਕਰ ਚੁੱਕਾ ਹੋਏਗਾ ਹਾਂਜੀ ਬਹੁਤ ਜੀ ਹਾਂਜੀ